ਹਾਂਜੀ ਮੈਂ ਅੰਤਰ ਰਾਸ਼ਟਰੀ ਪੱਧਰ 'ਤੇ ਆਯੋਜਿਤ ਕਿਸੇ ਫੋਟੋਗ੍ਰਾਫੀ ਮੁਕਾਬਲੇ ਵਿੱਚ ਹਿੱਸਾ ਲੈਣ ਦੀ ਇੱਛੁਕ ਹਾਂ ਕਿਉਂਕਿ ਮੈਨੂੰ ਫੋਟੋਗ੍ਰਾਫੀ ਦਾ ਬਹੁਤ ਸ਼ੌਂਕ ਹੈ ਮੈਂ ਫੋਟੋਗ੍ਰਾਫੀ ਦੇ ਵਿੱਚ ਬਹੁਤ ਰੁਚੀ ਰੱਖਦੀ ਹਾਂ ਫੋਟੋਗ੍ਰਾਫੀ ਵਿੱਚ ਹਿੱਸਾ ਲੈਣ ਦਾ ਮੇਰਾ ਮਤਲਬ ਹੈ ਕਿ ਮੈਨੂੰ ਸ਼ੁਰੂ ਤੋਂ ਹੀ ਬਚਪਨ ਤੋਂ ਹੀ ਫੋਟੋਗ੍ਰਾਫੀ ਦਾ ਬਹੁਤ ਸ਼ੌਂਕ ਸੀ ਜਦੋਂ ਵੀ ਮੈਂ ਕਿਤੇ ਬਾਹਰ ਜਾਂਦੀ ਹਾਂ ਮੈਂ ਦਰੱਖਤਾਂ ਦੀਆਂ ਪਰਬਤਾਂ ਦੀਆਂ ਫੋਟੋਆਂ ਲੈ ਲੈਂਦੀ ਰਹਿੰਦੀ ਹਾਂ ਅਤੇ ਬਹੁਤ ਸਾਰੀਆਂ ਮੈਂ ਆਪਣੇ ਘਰ ਫੋਟੋਆਂ ਪ੍ਰਿੰਟ ਕਰਕੇ ਇਕੱਠੀਆਂ ਕੀਤੀਆਂ ਹੋਈਆਂ ਨੇ ਜਿਹਨਾਂ ਦੇ ਵਿੱਚ ਮੈਂ ਬਹੁਤ ਸਾਰਾ ਡਾਟਾ ਬਣਾਇਆ ਹੋਇਆ ਆਪਣੇ ਮੋਬਾਇਲ ਦੇ ਵਿੱਚ ਵੀ ਮੈਂ ਫੋਟੋਗ੍ਰਾਫੀ ਦੇ ਗਰਾਫ ਬਣਾ ਕੇ ਰੱਖੇ ਹੋਏ ਨੇ ਇਸ ਫੋਟੋਗ੍ਰਾਫੀ ਤੋਂ ਮੈਨੂੰ ਬਹੁਤ ਅਨੰਦ ਮਿਲਦਾ ਹੈ ਮੇਰੇ ਮਨ ਨੂੰ ਸਕੂਨ ਮਿਲਦਾ ਹੈ ਮੈਂ ਫੋਟੋਗ੍ਰਾਫੀ ਤੋਂ ਮੈਨੂੰ ਸਿੱਖਣ ਨੂੰ ਵੀ ਬਹੁਤ ਕੁਛ ਮਿਲਦਾ ਹੈ ਮੈਂ ਇਸ ਜੇ ਜਦੋਂ ਵੀ ਮੈਨੂੰ ਜ਼ਿੰਦਗੀ ਵਿੱਚ ਕਦੇ ਵੀ ਹਿੱਸਾ ਲੈਣ ਦਾ ਮੌਕਾ ਮਿਲੇਗਾ ਤਾਂ ਮੈਂ ਇਸ ਵਿੱਚ ਹੁੰਮ ਹੁਮਾ ਕੇ ਵਧ ਚੜ ਕੇ ਹਿੱਸਾ ਲਊਂਗੀ ਕਿਉਂਕਿ ਫੋਟੋਗ੍ਰਾਫੀ ਮੈਂ ਸ਼ੁਰੂ ਤੋਂ ਹੀ ਕਰ ਰਹੀ ਹਾਂ ਅਤੇ ਮੈਨੂੰ ਇਸ ਬਾਰੇ ਬਹੁਤ ਸਾਰੀ ਜਾਣਕਾਰੀ ਹੈ ਅਤੇ ਮੈਂ ਫੋਟੋਗ੍ਰਾਫੀ ਵਿੱਚ ਰੁਚੀ ਲੈਂਦੀ ਹਾਂ ਅਤੇ ਲਵਾਂਗੀ ਤੇ ਲੈਂਦੀ ਰਹਾਂਗੀ ਅਤੇ ਜਦੋਂ ਕਿਤੇ ਵੀ ਮੈਨੂੰ ਮੌਕਾ ਮਿਲਿਆ ਮੈਂ ਜ਼ਿੰਦਗੀ ਵਿੱਚ ਆਪਣੀ ਫੋਟੋਗ੍ਰਾਫੀ ਵਿੱਚ ਹਿੱਸਾ ਲੈਣ ਲਈ ਸਭ ਤੋਂ ਅੱਗੇ ਆਵਾਂਗੀ